ਅੱਜ ਅਸੀਂ ਤੁਹਾਨੂੰ ਦੱਸਾਂਗੇ ਵੀ ਜਿਵੇਂ ਕਿਸੇ ਵਪਾਰਿਕ ਖੇਤਰ ਵਿੱਚ ਸਮੁੱਚੇ ਆਰਥਿਕ ਵਿਕਾਸ ਵਿੱਚ ਯੋਗਦਾਨ ਕਿਵੇਂ ਪਾਉਂਦਾ ਜਿਵੇਂ ਕਿਸੇ ਨੇ ਵੀ ਕੋਈ ਵੀ ਛੋਟਾ ਬਿਜ਼ਨਸ ਸ਼ੁਰੂ ਤੋਂ ਸਟਾਰਟ ਕਰਨਾ ਹੋਵੇ ਉਹ ਸਾਰਿਆਂ ਤੋਂ ਪਹਿਲਾਂ ਜਿਵੇਂ ਵੀ ਬੈਂਕ ਤੋਂ ਲੋਨ ਲੈਂਦਾ ਥੋੜ੍ਹਾ ਜਿਹਾ ਤਾਂ ਸਰਕਾਰ ਉਹਦੀ ਉਹਨੂੰ ਉਹਦੀ ਉਹਦੇ ਮਦਦ ਕਰਦੀ ਹੈ ਵੀ ਉਹਨੇ ਥੋੜ੍ਹਾ ਜਿਹਾ ਸਟਾਰਟਿੰਗ ਆਪਣਾ ਬਿਜ਼ਨਸ ਸਟਾਰਟ ਕਰਨਾ ਉਹ ਉਹਨੂੰ ਸਰਕਾਰ ਬੈਂਕ ਤੋਂ ਲੋ ਉਹ ਬੈਂਕ ਤੋਂ ਲੋਨ ਲੈਂ ਲੈਂਦਾ ਅਤੇ ਉਹਨੂੰ ਉਹ ਲੋਨ ਦੇ ਦਿੰਦੀ ਹੈ ਅਤੇ ਉਹ ਆਪਣਾ ਬਿਜ਼ਨਸ ਛੋਟਾ ਜਿਹਾ ਸਟਾਰਟ ਕਰਦਾ ਜਿਵੇਂ ਕੋਈ ਵੀ ਕੰਮ ਸ਼ ਸ਼ ਸਟਾਰਟ ਕਰ ਲੈਂਦਾ ਜਿਵੇਂ ਮੋਟਰ ਮੋਟਰ ਦਾ ਕੰਮ ਸਟਾਰਟ ਕਰਨਾ ਸਮਰਸੀਬਲ ਦਾ ਕੰਮ ਸਟਾਰਟ ਕਰ ਲੈਂਦਾ ਵਾ ਅਤੇ ਫਿਰ ਉਹਦਾ ਕੰਮ ਥੋੜ੍ਹਾ ਬਹੁਤ ਚੱਲ ਪੈਦਾ ਵਾ ਅੱਧੇ ਆਉਂਦਾ ਉਹਦਾ ਕੰਮ ਕਿੰਨੇ ਟਾਈਮ ਬਾਅਦ ਆ ਕੇ ਉਹਨੂੰ ਥੋੜ੍ਹਾ ਪ੍ਰੋਫਿਟ ਹੋਣ ਲੱਗਦਾ ਅਤੇ ਸਰਕਾਰ ਉਹਦਾ ਟੈਕਸ ਉਹਨਾਂ ਦਾ ਟੈਕਸ ਵੀ ਕੱਟਦੀ ਹੈ ਅਤੇ ਫਿਰ ਜਿੰਨਾ ਉਨ੍ਹਾਂ ਨੇ ਲੋਨ ਲਿੱਤਾ ਹੁੰਦਾ ਉਹਦੀਆਂ ਕਿਸ਼ਤਾਂ ਵੀ ਜਾਂਦੀਆਂ ਉਹ ਸਰਕਾਰ ਕੋਲ ਥੋੜ੍ਹਾ ਜਿਹਾ ਸਰਕਾਰ ਕੋਲ ਪੈਸਾ ਚਲ ਜਾਂਦਾ ਵਾ ਅਤੇ ਉਹ ਸਰਕਾਰ ਪੈਸਾ ਬਾਅਦ 'ਚੋਂ ਦੇਸ਼ ਦੇ ਵਿਕਾਸ 'ਤੇ ਲਾਉਂਦੀ ਆ ਅਤੇ ਜਿਹੜਾ ਪੈਸਾ ਉਹਨੂੰ ਟੈਕਸ ਤੋਂ ਗਿਆ ਹੁੰਦਾ ਤਾਂ ਉਹ ਵਿਕਾਸ ਦੇ ਵਿੱਚ ਲਾਉਂਦੀ ਜੇ ਇੰਨਾ ਇੱਥੇ ਪੰ ਆਪਣੇ ਇੰਡੀਆ 'ਤੇ ਲਾਉਂਦੀ ਤਾਂ ਗਵਰਮੈਂਟ ਜਿਹੜੇ ਲੋਕੀਂ ਹੁੰਦੇ ਉਨ੍ਹਾਂ ਵਾਸਤੇ ਉਹ ਸੋਚਦੀ ਆ ਵੀ ਇਹਨਾਂ ਵਾਸਤੇ ਕੁਛ ਹੋਰ ਅੱਗੇ ਕੀਤਾ ਜਾਵੇ ਜਿਹੜੇ ਰੁਜ਼ਗਾਰ ਵਿਹਲੇ ਫਿਰਨ ਦੇ ਹੁੰਦੇ ਹਾਂ ਉਨ੍ਹਾਂ ਵਾਸਤੇ ਉਹ ਵੀ ਇਨ੍ਹਾਂ ਨੂੰ ਵੀ ਕੰਮ ਕੁੰਮ ਮਿਲੇ ਵੀ ਐਵੇਂ ਭੁੱਖੇ ਨਾ ਮਰਨ ਅਤੇ ਜਿੱਦਾਂ ਕੰਪਨੀ ਕੁਪਨੀ ਕੋਈ ਵੱਡੀ ਹੋਰ ਕੋਈ ਮੌਲ ਖੋਲ੍ਹ ਦਿੰਦੀ ਆ ਉੱਥੇ ਉਹ ਪੈਸੇ ਲਾ ਦਿੰਦੇ ਆ ਅਤੇ ਛੋਟੀਆਂ ਮੋਟੀਆਂ ਉਨ੍ਹਾਂ ਵਾਸਤੇ ਕੰਮ ਕਾਰ ਖੁੱਲ੍ਹ ਜਾਂਦਾ ਵਾ